ਉੱਚਾਈਆਂ ਤੋਂ ਡਰਨ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਇੱਦਾਂ ਦਾ ਕਦੇ ਵੀ ਡਰ ਨਹੀਂ ਲੱਗਿਆ ਕਿਉਂਕਿ ਜੋ ਅਲ੍ਹੜ ਪੁਣੇ ਅਸੀਂ ਜੋ ਪਿੰਡਾਂ ਦੇ ਵਿੱਚ ਤੁਹਾਨੂੰ ਆਮ ਦੇਖਣ ਨੂੰ ਮਿਲਦੇ ਆ ਜਿਵੇਂ ਕਿ ਜਾਮਣ ਦਾ ਫਲ ਹੋ ਜਾਂਦਾ ਬੇਰ ਹੋ ਜਾਂਦੇ ਹੈਗੇ ਜੋ ਤੂਤੀਆਂ ਹੋ ਜਾਂਦੀਆਂ ਤੂਤ ਦੀਆਂ ਸ਼ਹਿਤੂਤ ਦੀਆਂ ਉਹਨਾਂ ਦੇ ਫਲ ਲੱਗਦੇ ਨੇ ਉਹ ਬਹੁਤ ਉੱਚਾਈ ਉੱਪਰ ਹੁੰਦੇ ਨੇ ਤਾਂ ਉਹਨਾਂ ਨੂੰ ਤੋੜਨ ਵਾਸਤੇ ਅਸੀਂ ਆਮ ਹੀ ਨੋਰਮਲ ਬਿਨਾਂ ਕਿਸੇ ਪੌੜੀ ਬਿਨਾਂ ਕਿਸੇ ਰੱਸੇ ਤੋਂ ਸਿੱਧਾ ਚੜ੍ਹ ਜਾਣਾ ਉੱਪਰ ਜਾ ਕੇ ਜਮ੍ਹਾਂ ਟੀਸੀ ਤੋਂ ਉਹਨਾਂ ਨੂੰ ਤੋੜ ਕੇ ਲਿਆਉਣਾ ਪੱਕੇ ਪੱਕਿਆਂ ਨੂੰ ਇਸ ਕਰਕੇ ਡਰ ਤਾਂ ਉੱਚਾਈ ਤੋਂ ਕਦੇ ਵੀ ਨਹੀਂ ਲੱਗਿਆ ਉਸ ਤੋਂ ਬਾਅਦ ਜਦੋਂ ਕਿਤੇ ਬਾਹਰ ਘੁੰਮਣ ਜਾਈਦਾ ਪਹਾੜ ਵਗੈਰਾ 'ਤੇ ਤਾਂ ਉੱਥੋਂ ਸੜਕ ਛੱਡ ਕੇ ਜੋ ਸਿੱਧਾ ਪਹਾੜ ਹੁੰਦਾ ਗਾ ਬਿਨਾਂ ਰੱਸੇ ਬਿਨਾਂ ਕਿਤੇ ਨਿੱਕੀ ਪਗਡੰਡੀ ਹੁੰਦੀ ਆ ਜਿਹੜੀ ਅਸੀਂ ਉਹ ਚੜ੍ਹ ਜਾਣਾ ਬਿਨਾਂ ਕਿਸੇ ਸਹਾਰੇ ਤੋਂ ਬਿਨਾਂ ਕਿਸੇ ਹੈਲਪ ਤੋਂ ਡਰ ਤਾਂ ਕਦੇ ਨਹੀਂ ਲੱਗਿਆ ਇਸ ਚੀਜ਼ ਤੋਂ